ਸਾਡੇ ਪਿੰਡ ਵਿੱਚ ਕਰਜ਼ਾ ਲੈਣਾ ਇੱਕ ਆਮ ਜਿਹੀ ਗੱਲ ਹੈ ਸਾਡੇ ਪਿੰਡਾਂ ਦੇ ਲੋਕ ਕਰਜ਼ਾ ਲੈਂਦੇ ਹੀ ਰਹਿੰਦੇ ਹਨ ਬਾਕੀ ਕੁਝ ਲੋਕ ਇੱਕ ਦੂਜੇ ਨੂੰ ਦੇਖ ਕੇ ਕਰਜ਼ਾ ਲੈਂਦੇ ਹਨ ਕਿ ਕਰਜ਼ਾ ਲੈ ਕੇ ਇਹ ਚੀਜ਼ ਲੈ ਲਈ ਜਾਵੇ ਅਤੇ ਕਰਜ਼ਾ ਉਤਾਰ ਦਿੱਤਾ ਤਾਂ ਬਾਕੀ ਖੇਤੀ ਲਈ ਜਾਂ ਕੋਈ ਕੰਮ ਸ਼ੁਰੂ ਕਰਨ ਲਈ ਵੀ ਕਰਜ਼ਾ ਲੈ ਲੈਂਦੇ ਹਨ ਅਤੇ ਕਰਜ਼ਾ ਲੈਣ ਲਈ ਜ਼ਿਆਦਾਤਰ ਲੋਕ ਬੈਂਕ ਨਾਲ ਸੰਪਰਕ ਕਰਦੇ ਹਨ ਬੈਂਕ ਕਰਜ਼ਾ ਦੇਣ ਤੋਂ ਮਨ੍ਹਾ ਕਰ ਦਿੰਦੀ ਹੈ ਤਾਂ ਲੋਕ ਪਿੰਡ ਦੇ ਕਿਸੇ ਤਕੜੇ ਜਿਮੀਦਾਰ ਨ ਕੋਲ ਕਰਜ਼ਾ ਲੈਣ ਜਾਂਦੇ ਜਾਂਦੇ ਲੈ ਕੇ ਅਤੇ ਕਰਜ਼ਾ ਲੈ ਲੈਂਦੇ ਹਨ ਅਤੇ ਲੋਕਾਂ ਦੇ ਬਹੁਤ ਹੀ ਮਾੜੇ ਪ੍ਰਭਾਵ ਦੇਖੇ ਹਨ ਜਦੋਂ ਕਰਜ਼ਾ ਨਹੀਂ ਦਿੱਤਾ ਜਾਂਦਾ ਤਾਂ ਲੋਕ ਆਤਮ ਹੱਤਿਆ ਕਰ ਲੈਂਦੇ ਹਨ ਜਾਂ ਫਿਰ ਜ਼ਮੀਨ ਜਾਂ ਘਰ ਤੱਕ ਵੀ ਵਿਕ ਜਾਂਦਾ ਹੈ